ਜਿਹੜੇ ਸੈਲਾਨੀ ਟ੍ਰੈਕਿੰਗ ਰਾਫਟਿੰਗ ਅਤੇ ਰੌਕ ਕਲਾਈਬਿੰਗ ਵਿੱਚ ਦਿਲਚਸਪੀ ਰੱਖਦੇ ਹਨ ਉਹਨਾਂ ਦੇ ਲਈ ਵੀ ਇੱਥੇ ਬਹੁਤ ਸਾਰੇ ਵਿਕਲਪ ਹਨ ਜਿਵੇਂ ਰਣਜੀਤ ਸਾਗਰ ਡੈਮ ਰਣਜੀਤ ਸਾਗਰ ਡੈਮ ਦੇ ਵਿੱਚ ਰਾਫਟਿੰਗ ਦੀ ਵਿਸ਼ੇਸ਼ ਸੁਵਿਧਾ ਹੈ ਰੌਕ ਕਲਾਈਬਿੰਗ ਵਾਸਤੇ ਖਾਲਸਾ ਕੋਲੇਜ ਦੇ ਵਿੱਚ ਵੀ ਇੱਕ ਅਲੱਗ ਤੋਂ ਮੈਦਾਨ ਬਣਿਆ ਹੋਇਆ ਹੈ ਅਤੇ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਇਸਦੀ ਖਾਸ ਸੁਵਿਧਾ ਉਪਲਬਧ ਹੈ ਤਰਨ ਤਾਰਨ ਦੇ ਨਾਲ ਲੱਗਦੇ ਹਰੀਕੇ ਦਰਿਆ ਦੇ ਬਰਡ ਸੈਂਚਰੀ ਇੱਕ ਬਹੁਤ ਵਧੀਆ ਵਿਕਲਪ ਹੈ ਜਿਸ ਦੇ ਵਿੱਚ ਅਸੀਂ ਟ੍ਰੈਕਿੰਗ ਕਰ ਸਕਦੇ ਹਾਂ ਰਾਫਟਿੰਗ ਵੀ ਕਰ ਸਕਦੇ ਹਾਂ ਅਤੇ ਰੌਕ ਕਲਾਈਬਿੰਗ ਵੀ ਕਰ ਸਕਦੇ ਹਾਂ ਇੱਥੇ ਆਉਣ ਵਾਲੇ ਜਿੰਨੇ ਵੀ ਟੂਰਿਸਟ ਹਨ ਉਹ ਇਸਦਾ ਬਹੁਤ ਵਧੀਆ ਅਨੁਭਵ ਲੈਂਦੇ ਹਨ ਹਰੀਕਾ ਦਰਿਆ ਦੇ ਵਿੱਚ ਜਿੱਥੇ ਬਰਡ ਸੈਂਚਰੀ ਬਣੀ ਹੋਈ ਹੈ ਇੱਕ ਬਹੁਤ ਹੀ ਸ਼ਾਂਤ ਅਤੇ ਖੁੱਲ੍ਹਾ ਏਰੀਆ ਹੈ ਦੇਖਣ ਦੇ ਵਿੱਚ ਇਹ ਕੁਦਰਤੀ ਨਜ਼ਾਰਿਆਂ ਦੇ ਨਾਲ ਭਰਿਆ ਹੋਇਆ ਹੈ ਜਿੱਥੇ ਅਲੱਗ ਅਲੱਗ ਤਰ੍ਹਾਂ ਦੇ ਪਸ਼ੂ ਪੰਛੀ ਆਦਿ ਬਹੁਤਾਤ ਵਿੱਚ ਮੌਜੂਦ ਹਨ ਇੱਥੋਂ ਦਾ ਅਲੱਗ ਹੀ ਅਨੁਭਵ ਹੈ